ਭੰਗੜਾ ਪੰਜਾਬ ਦੇ ਵਿੱਚ ਬਹੁਤ ਹੀ ਪ੍ਰਚਲਿਤ ਪ੍ਰਸਿੱਧ ਨਾਚ ਹੈ ਅਤੇ ਇਹ ਖਾਸ ਤੌਰ 'ਤੇ ਮਰਦਾਂ ਦੇ ਲਈ ਹੁੰਦਾ ਹੈ ਭੰਗੜੇ ਦੇ ਪ੍ਰਦਰਸ਼ਨ ਦੇ ਲਈ ਜੋ ਪਹਿਰਾਵਾ ਹੁੰਦਾ ਹੈ ਉਹ ਬਹੁਤ ਹੀ ਸ਼ਾਨਦਾਰ ਅਤੇ ਰੰਗੀਨ ਕਲਰ ਦਾ ਹੁੰਦਾ ਹੈ ਭੰਗੜਾ ਇੱਕ ਟ੍ਰਡੀਸ਼ਨਲ ਪੰਜਾਬੀ ਡਾਂਸ ਹੈ ਜਿਹਦੇ ਵਿੱਚ ਲੋਕਾਂ ਦੇ ਲਈ ਜਿਹਦੇ ਵਿੱਚ ਲੋਕਾਂ ਦੇ ਲਈ ਐਨਰਜੀ ਅਤੇ ਕਲਚਰ ਨੂੰ ਰਿਫਲੈਕਟ ਕਰਦਾ ਹੈ ਭੰਗੜੇ ਦੇ ਡਾਂਸਰ ਅਕਸਰ ਕਲਰਫੁੱਲ ਕੁੜਤੇ ਲੂੰਗੀ ਪਗੜੀਆਂ ਪਾਉਂਦੇ ਹਨ ਜੋ ਕਿ ਉਹਨਾਂ ਨੂੰ ਹੋਰ ਵੀ ਆਕਰਸ਼ਿਤ ਕਰਦੇ ਹਨ ਅਤੇ ਕੁੜਤੀ ਅਕਸਰ ਧੋਤੀ ਸਟਾਈਲ ਦੀ ਹੁੰਦੀ ਹੈ ਤਾਂ ਜੋ ਉਹ ਮੂਮੈਂਟ ਨੂੰ ਆਸਾਨ ਬਣਾਉਂਦੇ ਹਨ ਅਤੇ ਡਾਂਸਰ ਨੂੰ ਕੰਫਰਟੇਬਲ ਕਰਦੇ ਹਨ ਅਤੇ ਉਹਨਾਂ ਨੂੰ ਫਰੀਡਮ ਦਿੰਦੇ ਹਨ ਲੂੰਗੀ ਜੋ ਕਿ ਇੱਕ ਟ੍ਰਡੀਸ਼ਨਲ ਬੋਟਮ ਵੀਅਰ ਹੈ ਅਤੇ ਇਹ ਵੀ ਇੱਕ ਭੰਗੜੇ ਦੇ ਵਿੱਚ ਹੀ ਪਹਿਰਾਵਾ ਹੁੰਦਾ ਹੈ ਅਤੇ ਇਹ ਬਹੁਤ ਹੀ ਕੰਫਰਟੇਬਲ ਹੁੰਦਾ ਹੈ ਤਾਂ ਜੋ ਇਹ ਖੁੱਲ੍ਹੇ ਇਹ ਲੂੰਗੀ ਖੁੱਲ੍ਹੇ ਡਿਜ਼ਾਇਨ ਨਾਲ ਡਿਜ਼ਾਇਨਰ ਦੁਆਰਾ ਤਿਆਰ ਕੀਤੀ ਜਾਂਦੀ ਤਾਂ ਜੋ ਉਹ ਆਪਣੇ ਮੂਵਮੈਂਟ ਨੂੰ ਪੂਰੀ ਤਰ੍ਹਾਂ ਕਰ ਸਕੇ ਉਹਨਾਂ ਨੂੰ ਬਿਨਾਂ ਪ੍ਰੋਬਲਮ ਤੋਂ ਪੱਗੜੀ ਵੀ ਭੰਗੜੇ ਦੇ ਦੇ ਵਿੱਚ ਇੱਕ ਇੰਪੋਰਟੈਂਟ ਹਿੱਸਾ ਹੈ ਜੋ ਕਿ ਲੋਕਾਂ ਦੀਆਂ ਅਡੈਂਟਿਟੀ ਨੂੰ ਦਰਸਾਉਂਦਾ ਹੈ ਪੱਗੜੀ ਦੇ ਰੰਗ ਦੇ ਡਿਜ਼ਾਇਨ ਵੱਖਰੇ ਵੱਖਰੇ ਹੁੰਦੇ ਨੇ ਜੋ ਡਾਂਸਰ ਦੀ ਪਰਸਨੈਲਿਟੀ ਨੂੰ ਵਿਖਾਉਂਦੇ ਹਨ ਭੰਗੜੇ ਦੇ ਡਾਂਸਰ ਨੂੰ ਅਟਰੈਕਟਿਵ ਬਣਾਉਣ ਦੇ ਲਈ ਵੀ ਸਿਰਫ ਕੱਪੜੇ ਹੀ ਨਹੀਂ ਪਰ ਉਹਨਾਂ ਦੀ ਪਰਫੋਰਮੈਂਸ ਅਤੇ ਐਨਰਜੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੋ ਕਿ ਉਹਨਾਂ ਦੀ ਪਰਫੋਰਮੈਂਸ 'ਤੇ ਡਪੈਂਡ ਕਰਦੀ ਹੈ ਭੰਗੜਾ ਇਸਦੇ ਭੰਗੜੇ ਦੇ ਵਿੱਚ ਹਾਈ ਅਨਰਜੀ ਮੂਵਮੈਂਟ ਬੀਟ ਸਾਰਾ ਕੁਛ ਓਡੀਅੰਸ ਅਟਰੈਕਟਿਵ ਸਭ ਚੀਜ਼ ਨੋਟਿਸ ਹੁੰਦੀ ਹੈ ਅਤੇ ਇਹ ਕੁੜੀ ਉਹ ਖੁਦ ਨੂੰ ਐਕਸਪ੍ਰੈਸ ਕਰਦੇ ਹਨ ਅਤੇ ਖੁਦ ਨੂੰ ਐਕਸਪ੍ਰੈਸ ਕਰਦੇ ਹਨ ਅਤੇ ਓਡੀਅੰਸ ਅਟਰੈਕਟਿਵ ਖੁਦ ਉਹਨਾਂ ਦੁਆਰਾ ਹੀ ਹੁੰਦੇ ਹਨ ਤਾਂ ਵੀ ਉਹਨਾਂ ਦੀ ਕੌਫੀਡੈਂਸ ਲੈਵਲ ਵੱਧ ਹੋ ਸਕੇ ਅਤੇ ਅਗ ਉਹ ਉਹਨਾਂ ਨੂੰ ਅਟਰੈਕਟਿਵ ਦਿਖਾਉਣ ਦੇ ਲਈ ਵੱਧ ਤੋਂ ਵੱਧ ਐਨਰਜੀ ਦਿਖਾਉਂਦੇ ਹਨ ਇਸ ਦੇ ਨਾਲ ਭੰਗੜੇ ਦੀ ਲੁੱਕ ਨੂੰ ਲੁੱਕ ਨੂੰ ਵੀ ਪੂਰਾ ਕਰਦੇ ਹਨ ਐਵੇਂ ਹੀ ਟ੍ਰਡੀਸ਼ਨਲ ਜਵੈਲਰੀ ਵੀ ਪਾਉਂਦੇ ਹਨ ਬੈਂਗਲਸ ਪਾਉਂਦੇ ਹਨ ਏਅਰਿੰਗਸ ਪਾਉਂਦੇ ਹਨ ਜਿਹਨਾਂ ਦੇ ਨਾਲ ਉਹ ਆਪਣੀ ਅਕੋਨੂ